ਮੈਂ ਭੁਪਿੰਦਰ ਸਿੰਘ ਗੁਰਦਾਸਪੁਰ ਦਾ ਰਹਿਣ ਵਾਲਾ ਅੱਜ ਤੁਹਾਡੇ ਨਾਲ ਆਪਣਾ ਕਸ਼ਮੀਰ ਟੂਰ ਸਾਂਝਾ ਕਰਨਾ ਚਾਹੁੰਦਾ ਹਾਂ ਸਟਾਰਟਿੰਗ ਦੇ ਵਿੱਚ ਜਿਹੜੀ ਸਾਡੀ ਸਭ ਤੋਂ ਪਹਿਲੀ ਦਿੱਕਤ ਰਹੀ ਉਹ ਰਹੀ ਸਾਧਨ ਦੀ ਵੀ ਸਾਡੇ ਲਈ ਸਭ ਤੋਂ ਬਿਹਤਰੀਨ ਸਾਧਨ ਦਾ ਸਫਰ ਕਿਹੜਾ ਰਵੇ ਹੁਣ ਜਿੱਦਾਂ ਆਪਾਂ ਜੇਕਰ ਬੱਸ ਕਰੀਏ ਤੇ ਬੱਸ ਦੇ ਵਿੱਚ ਸਾਨੂੰ ਮਿਨੀਮਮ ਘੱਟੋਂ ਘੱਟ ਵੀ ਛੇ ਤੋਂ ਸੱਤ ਘੰਟੇ ਲੱਗਦੇ ਹਨ ਜੇਕਰ ਆਪਾਂ ਆਪਣੇ ਖੁਦ ਦੇ ਸਾਧਨ ਤੇ ਜਾਈਏ ਤੇ ਸਾਨੂੰ ਉੱਥੇ ਪੰਜ ਘੰਟੇ ਲੱਗਦੇ ਹਨ ਜੇ ਆਪਾਂ ਆਪਣੇ ਸਾਧਨ ਤੇ ਜਾਈਏ ਤੇ ਸਾਨੂੰ ਸਫਰ ਕਰਨਾ ਥੋੜਾ ਮੁਸ਼ਕਿਲ ਹੋ ਜਾਂਦਾ ਹੈ ਤੇ ਹੋ ਜਾਏਗਾ ਤੇ ਜੇਕਰ ਆਪਾਂ ਬੱਸ ਦੇ ਵਿੱਚ ਜਾਦੇ ਆ ਤੇ ਸਫਰ ਕਰਨਾ ਥੋੜਾ ਆਸਾਨ ਹੋ ਜਾਵੇਗਾ ਤੇ ਆਪਾਂ ਉਹਦੇ ਵਿੱਚ ਆਰਾਮ ਨਾਲ ਵੀ ਜਾ ਸਕਦੇ ਹਾਂ ਇਸ ਤੋਂ ਬਾਅਦ ਉਥੋਂ ਦਾ ਮੌਸਮ ਮੌਸਮ ਜਿੱਦਾਂ ਕਿ ਰਾਹ ਵਿੱਚ ਬਦਲਦਾ ਰਿਹਾ ਬਾਰਿਸ਼ ਲੱਗਦੀ ਰਹੀ ਠੰਡੀਆ ਹਵਾਵਾਂ ਤੇ ਬਰਫ ਤੇ ਠੰਡੇ ਮੌਸਮ ਦਾ ਸਾਨੂੰ ਥੋੜਾ ਸਾਹਮਨਾ ਕਰਨਾ ਪਿਆ ਤੇ ਉੱਥੇ ਖਾਣ ਪੀਣ ਦੀ ਦਿੱਕਤ ਜਿਹੜੀ ਸਭ ਤੋਂ ਸਾਨੂੰ ਜਿਆਦਾ ਆਈ ਉੱਥੇ ਖਾਣਾ ਪੀਣਾ ਬਹੁਤ ਮਹਿੰਗਾ ਸੀ ਹੋਟਲ ਰੈਂਟ ਬਹੁਤ ਮਹਿੰਗਾ ਸੀ ਤੇ ਰਹਿਣ ਸਹਿਣ ਬਹੁਤ ਮਹਿੰਗਾ ਸੀ ਅਸੀਂ ਉਥੇ ਚਾਰ ਦਿਨ ਬਿਤਾਏ ਤੇ ਚਾਰਾਂ ਦਿਨਾਂ ਦੇ ਵਿੱਚ ਜਿਹੜੀ ਸਾਡੀ ਮੇਨ ਦਿੱਕਤ ਸੀ ਉਹ ਸੀਗੀ ਰਹਿਣ ਸਹਿਣ ਦੀ ਰਹਿਣ ਸਹਿਣ ਦਾ ਰੈਂਟ ਬਹੁਤ ਜਿਆਦਾ ਸੀ ਉਸ ਤੋਂ ਬਾਅਦ ਖਾਣ ਪੀਣ ਦੇ ਵਿੱਚ ਨੋਰਮਲ ਸਾਡੇ ਜੋ ਵੀ ਉਥੇ ਸਾਨੂੰ ਮਲਬਕੀ ਪਰੋਂਠੇ ਘਰ ਦੀ ਦਾਲ ਰੋਟੀ ਉਹ ਬਹੁਤ ਹੀ ਮਹਿੰਗੀ ਸੀ ਤੇ ਆਪਾਂ ਉਥੇ ਚਾਰ ਦਿਨ ਬਿਤਾਏ ਉਸ ਤੋਂ ਬਾਅਦ ਆਪਾਂ ਕਸ਼ਮੀਰ ਤੋਂ ਅੱਗੇ ਚਲੇ ਗਏ ਕਸ਼ਮੀਰ ਦੇ ਅੱਗੇ ਜਾਣ ਤੇ ਓਹ ਫਿਰ ਆਪਾਂ ਬੱਸ ਦਾ ਸਫਰ ਕੀਤਾ ਤੇ ਬੱਸ ਦਾ ਜਿਹੜਾ ਕਰਾਇਆ ਸੀਗਾ ਉਹ ਸੀਗਾ ਸੱਤਰ ਰੁਪਏ ਇਨਾ ਬਹੁਤ ਸੀ ਆਪਾਂ ਇਹ ਸਫਰ ਸਾਡਾ ਬਹੁਤ ਹੀ ਬਹਿਤਰੀਨ ਰਿਹਾ